ਬਦਲਦੇ ਸਮੇਂ ਨਾਲ ਖੇਡਾਂ ਦੇ ਵਿੱਚ ਵੀ ਬਦਲਾਅ ਆ ਗਿਆ ਹੈ ਜਿੱਥੇ ਪਹਿਲਾਂ ਬੱਚੇ ਆਊਟਡੋਰ ਗੇਮਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਸਨ ਪਰ ਅੱਜ ਕੱਲ੍ਹ ਔਨਲਾਈਨ ਵੀਡਿਓ ਗੇਮਾਂ ਆਉਣ ਕਾਰਨ ਵੀਡਿਓ ਗੇਮਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਰੋਜ਼ ਨਵੀਆਂ ਨਵੀਆਂ ਵੀਡਿਓ ਗੇਮਾਂ ਆ ਰਹੀਆਂ ਹਨ ਜਿਵੇਂ ਪਬਜੀ ਕੈਂਡੀ ਕ੍ਰਸ਼ ਮਿੰਨੀ ਮਿਲਟੀਆ ਜੀ ਟੀ ਏ ਆਦਿ ਜੇਕਰ ਅਸੀਂ ਜੀ ਟੀ ਏ ਦੀ ਗੱਲ ਕਰੀਏ ਜਿਵੇਂ ਕਿ ਆਮ ਜ਼ਿੰਦਗੀ ਵਾਂਗ ਹੀ ਉਸ ਵਿੱਚ ਵ ਇੱਕ ਬੰਦਾ ਹੁੰਦਾ ਹੈ ਜੋ ਕਿ ਅਲੱਗ ਅਲੱਗ ਮਿਸ਼ਨ ਪੂਰੇ ਕਰਦਾ ਹੈ ਉਹਨਾਂ ਮਿਸ਼ਨਾਂ ਨੂੰ ਪੂਰੇ ਕਰਦੇ ਸਾਰ ਹੀ ਉਨ੍ਹਾਂ ਉਸ ਨੂੰ ਪੈਸੇ ਮਿਲਦੇ ਹਨ ਉਹ ਇਹ ਪੈਸਿਆਂ ਦੀ ਮਦਦ ਗੈਲ ਉਹ ਘਰ ਜਾਂ ਕਾਰਾਂ ਆਦਿ ਚੀਜ਼ਾਂ ਖਰੀਦ ਸਕਦਾ ਹੈ ਇਹ ਗੇਮ ਸੇਮ ਆਮ ਜ਼ਿੰਦਗੀ ਵਾਂਗ ਹੀ ਹੈ ਇਹਨਾਂ ਗੇਮਾਂ ਨੂੰ ਖੇਡ ਕੇ ਬਹੁਤ ਮਜ਼ਾ ਆਉਂਦਾ ਹੈ